ਪੰਜਾਬ ਵਿੱਚ ਬਹੁਤ ਸਾਰੀਆਂ ਖੇਡਾਂ ਖੇਡੀਆਂ ਜਾਂਦੀਆਂ ਹਨ ਜਿਵੇਂ ਕਿ ਗੁੱਲੀ ਡੰਡਾ ਕਬੱਡੀ ਬਾਸਕਿਟਬੋਲ ਸਵਿਵਿੰਗ ਬੈਡਮਿੰਟਨ ਦੋੜਾਂ ਕਰਵਾਈਆਂ ਜਾਂਦੀਆਂ ਹਨ ਆਦਿ ਬਹੁਤ ਸਾਰੀਆਂ ਖੇਡਾਂ ਖੇਡੀਆਂ ਜਾਂਦੀਆਂ ਹਨ ਪੰਜਾਬ ਵਿੱਚ ਪੰਜਾਬ ਤੋਂ ਇਲਾਵਾ ਜ ਕਬੱਡੀ ਜੋ ਕਿ ਹੈ ਉਹ ਸਿਰਫ ਪੰਜਾਬ ਵਿੱਚ ਹੀ ਖੇਡੀ ਜਾਂਦੀ ਸੀ ਪਹਿਲਾਂ ਸਮਿਆਂ ਵਿੱਚ ਪਰ ਹੁਣ ਅੱਜ ਕੱਲ੍ਹ ਕਬੱਡੀ ਜੋ ਕਿ ਆ ਅੰਤਰਰਾਸ਼ਟਰੀ ਰਾਜਾਂ ਵਿੱਚ ਵੀ ਜਿਹੜੀ ਹੈ ਉਹ ਖੇਡੀ ਜਾਂਦੀ ਆ ਅਤੇ ਜੋ ਕਿ ਇਹ ਪੰਜਾਬ ਵਿੱਚ ਮਾਣ ਵਾਲੀ ਗੱਲ ਹੈ ਇੱਕ ਪੰਜਾਬ ਲਈ ਮਾਣ ਵਾਲੀ ਗੱਲ ਹੈ ਉਹ ਹੈ ਕਿ ਹੋਰ ਵੀ ਬਹੁਤ ਸਾਰੀਆਂ ਖੇਡਾਂ ਜੋ ਕਿ ਹੈ ਉਹ ਖੇਡੀਆਂ ਜਾਂਦੀਆਂ ਹਨ